ਸਥਾਨਕ ਕਲਾਕਾਰ ਬਹੁਤ ਤਰੀਕਿਆਂ ਨਾਲ ਆਪਣੀ ਕਲਾ ਨੂੰ ਦਰਸਾਉਂਦੇ ਹਨ ਜਿਵੇਂ ਕਿ ਉਹ ਆਪਣੀ ਪੇਂਟਿੰਗਜ਼ ਦੇ ਰਾਹੀਂ ਪੰਜਾਬ ਦਾ ਇਤਿਹਾਸ ਪੰਜਾਬ ਦਾ ਲੋਕ ਨਾਚ ਦਰਸਾਉਂਦੇ ਹਨ ਇਸੇ ਤਰ੍ਹਾਂ ਹੀ ਇਸਨੂੰ ਇੱਕ ਨਵਾਂ ਰੂਪ ਦਿੱਤਾ ਜਾਂਦਾ ਹੈ